ਮੇਰਾ ਇੱਕ ਦੋਸਤ ਸੀ ਉਹ ਉੱਚੀ ਸਿੱਖਿਆ ਪ੍ਰਾਪਤ ਕਰਨਾ ਚਾਹੁੰਦਾ ਸੀਗਾ ਪਰ ਘਰੋਂ ਗਰੀਬ ਸੀਗਾ ਅਤੇ ਉਹਨੂੰ ਪੂਰਾ ਵਿਸ਼ਵਾਸ ਸੀ ਕਿ ਮੈਂ ਸਿੱਖਿਆ ਪ੍ਰਾਪਤ ਕਰਨੀ ਐਂ ਅਤੇ ਉਹਨੂੰ ਫਿਰ ਕਿਸੇ ਨੂੰ ਦੱਸਿਆ ਤੁਸੀਂ ਸਿੱਖਿਆ ਬਾਰੇ ਕਰਜ਼ਾ ਲੈ ਸਕਦੇ ਹੋ ਉਹਨੇ ਫਿਰ ਸੰਪਰਕ ਕੀਤਾ ਕਰਜ਼ਾ ਲਿਆ ਕਰਜ਼ਾ ਲੈ ਕੇ ਫਿਰ ਬਾਹਰਲੇ ਮੁਲਕ 'ਚ ਉਚੇਚੀ ਪੜ੍ਹਾਈ ਕਰਨ ਗਿਆ ਉੱਥੋਂ ਉਹਨੇ ਪੜ੍ਹ ਕੇ ਜੋ ਵੀ ਕੁਛ ਉਹਨੇ ਕਰਨਾ ਸੀਗਾ ਸਾਰਾ ਕੋਰਸ ਕਰਕੇ ਉਹਨੂੰ ਕੋਈ ਵ ਰਾਹ ਵਿੱਚ ਕੋਈ ਰੁਕਾਵਟ ਨਹੀਂ ਆਈ ਅਤੇ ਕਰਜੇ ਕਰਕੇ ਉੱਥੇ ਫਿਰ ਉਹ ਸਾਰਾ ਸਿਲੇਬਸ ਪੂਰਾ ਕਰਕੇ ਸਾਰੀ ਡਿਗਰੀ ਪ੍ਰਾਪਤ ਕਰਕੇ ਫਿਰ ਉਹ ਚੰਗੀ ਉੱਚੀ ਨੌਕਰੀ ਦੇ ਪਦ 'ਤੇ ਲੱਗਾ ਅਤੇ ਉਹਦੇ ਬਾਅਦ ਉਹਨੇ ਸਾਰਾ ਆਪਣਾ ਕਰਜਾ ਜਿਹੜਾ ਲਾਹ ਦਿੱਤਾ ਅਤੇ ਬਹੁਤ ਖੁਸ਼ੀ ਮਹਿਸੂਸ ਉਹਨੇ ਕੀਤੀ ਕਿ ਮੈਂ ਕਰਨਾ ਚਾਹੁੰਦਾ ਸੀਗਾ ਮੇਰੀ ਸਬ ਮਿਹਨਤ ਬਹੁਤ ਸਬਤ ਹੋਈ ਸਫਲ ਹੋਈ ਏ